ਮੈਮ ਮੈਂ ਰਣਜੀਤ ਕੌਰ ਗੱਲ ਕਰ ਰਹੀ ਹਾਂ ਪਿੰਡ ਸੰਘਾ ਤੋਂ ਮੈਮ ਅਸੀਂ ਤੁਹਾਡੇ ਕਲੱਬ ਬਾਰੇ ਬਹੁਤ ਸੁਣਿਆ ਹੈ ਤੁਸੀਂ ਬੱਚਿਆਂ ਨੂੰ ਬਹੁਤ ਸੋਹਣੇ ਐਕਟੀਵਿਟੀਜ਼ ਕਰਵਾਉਂਦੇ ਹੋ ਅੱਛਾ ਮੈਮ ਔਰ ਮੈਮ ਕਲਾਸਿਸ ਸੁਬਹ ਹੀ ਲੱਗਣਗੀਆਂ ਇਹਨਾਂ ਦੀਆਂ ਹੋਰ ਇਸ ਤੋਂ ਇਲਾਵਾ ਮੈਮ ਹਾਂਜੀ ਇਸ ਤੋਂ ਇਲਾਵਾ ਕੀ ਤੁਹਾਡੇ ਕੋਲ ਵਾਟਰ ਪਾਰਕ ਦੀਆਂ ਔਰ ਝੂਲੇ ਵਗੈਰਾ ਇਹ ਸਾਰੇ ਕੁਛ ਸਾਰੀਆਂ ਸੁਵਿਧਾਵਾਂ ਉਪਲਬਧ ਨੇ ਅੱਜ ਕੱਲ੍ਹ ਦੇ ਬੱਚੇ ਤੁਹਾਨੂੰ ਪਤਾ ਹੀ ਹੈ ਮੈਮ ਸਾਰਾ ਦਿਨ ਬਸ ਫੋਨਾਂ 'ਤੇ ਲੱਗੇ ਰਹਿੰਦੇ ਨੇ ਔਰ ਆਪਾਂ ਚਾਹੁੰਦੇ ਹਾਂ ਕਿ ਬੱਚੇ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿਣ ਔਰ ਅ ਥੋੜ੍ਹੇ ਐਕਟਿਵ ਵੀ ਹੋਣ ਤਾਂ ਕਿ ਉਹਨਾਂ ਦਾ ਜਿਹੜਾ ਉਹ ਸਰੀਰ ਉਹ ਇਕਦਮ ਫਿਟ ਹੋਵੇ ਹੈ ਨਾ ਇਸ ਲਈ ਅਸੀਂ ਤੁਹਾਡੇ

ਹਾਂਜੀ ਕਿਉਂਕਿ ਹੈਲਥ ਇਜ ਵੈਲਥ ਆਪਾਂ ਹੈਲਥ ਨੂੰ ਲੈ ਕੇ ਸਾਰਾ ਕੁਛ ਆਪਾਂ ਨੂੰ ਕਰਨਾ ਪੈਂਦਾ ਕਿਉਂਕਿ ਅੱਜ ਕੱਲ੍ਹ ਬੱਚੇ ਘਰ ਤੋਂ ਬਾਹਰ ਨਹੀਂ ਨਿਕਲਦੇ ਸਾਰਾ ਦਿਨ ਫੋਨਾਂ ਵਿੱਚ ਲੱਗੇ ਰਹਿੰਦੇ ਨੇ ਇਸ ਲਈ ਅਸੀਂ ਤੁਹਾਡੇ ਕੀ ਅਸੀਂ ਭਰੋਸਾ ਕਰ ਸਕਦੇ ਹਾਂ ਤੁਹਾਡੀ ਸਰਵਿਸ 'ਤੇ ਠੀਕ ਹੈ ਜੀ ਅਤੇ ਕਿੰਨੀ ਫੀਸ ਹੈਗੀ ਮੈਮ ਤੁਸੀਂ ਕਿੰਨਾ ਟਾਈਮ ਲਗਾ ਸਕਦੇ ਹੋ ਬੱਚੇ ਨੂੰ ਅਤੇ ਫੀਸ ਵਗੈਰਾ ਦਾ ਕੀ ਠੀਕ ਹੈ ਜੀ ਅਤੇ ਜੇ ਅਸੀਂ ਇੱਕ ਤੋਂ ਜ਼ਿਆਦਾ ਬੱਚੇ ਮਤਲਬ ਕਿ ਅਸੀਂ ਆਪਣੀ ਗਲੀ ਵਾਲੇ ਹੋਰ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਂਦੇ ਹਾਂ ਕੀ ਤੁਸੀਂ ਡਿਸਕਾਊਂਟ ਕਰੋਂਗੇ ਠੀਕ ਹੈ ਜੀ ਫਿਰ ਕਿੱਦਣ ਤੋਂ ਅਸੀਂ ਬੱਚੇ ਨੂੰ ਭੇਜ ਸਕਦੇ ਹਾਂ ਮੈੈਮ ਠੀਕ ਹੈ ਜੀ ਠੀਕ ਹੈ ਜੀ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਫਿਰ ਸੈ ਸ਼ਾਮ ਨੂੰ ਹੀ ਮਿਲਦੇ ਹਾਂ ਤੁਹਾਨੂੰ ਠੀਕ ਹੈ ਜੀ ਆਪਾਂ ਨੂੰ ਬੱਚੇ ਦੀ ਹੈਲਥ ਔਰ ਸਿਕਿਉਰਟੀ ਦੋਨੋਂ ਹੀ ਚਾਹੀਦੀਆਂ ਮੈਮ ਹਾਂਜੀ ਮੈਮ ਚਲੋ ਠੀਕ ਹੈ ਜੀ ਫਿਰ ਅਸੀਂ ਸ਼ਾਮ ਨੂੰ ਮਿਲਦੇ ਹਾਂ ਠੀਕ ਹੈ ਥੈਂਕ ਯੂ ਮੈਮ